ਭਾਅ ਜੀ ਜੀ ਤੁਸੀਂ ਸੁਣਾਓ ਹਾਂਜੀ ਉਹ ਮੈਂ ਅ ਬਿਜ਼ੀ ਸੀ ਥੋੜ੍ਹਾ ਅਤੇ ਮੈਂ ਅ ਰਾਸਿਲ ਖ਼ਤਮ ਹੋ ਗਿਆ ਸੀ ਅਤੇ ਮੈਂ ਸੋਚਿਆ ਕਿ ਹੁਣ ਜਾਨੀ ਆ ਚੱਕਰ ਲਾਉਣ ਮੈਂ ਚਾਵਲ ਲੈਣੇ ਸੀ ਅਤੇ ਤੁਸੀਂ ਹੁਣ ਕਿਹੜੇ ਕਿਹੜੇ ਹੈਗੇ ਆ ਕੀ ਹਿਸਾਬ ਕਿਤਾਬ ਹੈ ਅੱਛਾ ਬਾਸਮਤੀ ਦਾ ਰੇਟ ਦੱਸਿਓ ਮੈਮ ਅੱਛਾ ਇਹਨਾਂ 'ਚ ਕੀ ਡਿਫਰੈਂਸ ਹੈ ਅੱਛਾ ਅਤੇ ਜਿਹੜੇ ਸੱਠ ਵਾਲੇ ਆ ਉਹ ਚਲੋ ਤੁਸੀਂ ਸੱਠ ਵਾਲੇ ਦੇ ਦਿਓ ਹਾਂਜੀ ਪੰਜ ਕਿਲੋ ਕਰ ਦਿਓ